ਟੈਕਨੋਲੋਜੀ ਛੋਟੇ ਕਾਰੋਬਾਰਾਂ ਦੇ ਵਿਕਾਸ ਵਿੱਚ ਬਹੁਤ ਮਦਦ ਕੀਤੀ ਐ ਜਿਵੇਂ ਕੀ ਤੁਸੀਂ ਜਾਣਦੇ ਹੋ ਕੀ ਪੁਰਾਣੇ ਸਮੇਂ ਦੇ ਵਿੱਚ ਲੋਕ ਜੋ ਕੀ ਆਪ ਛੋਟੇ ਵਪਾਰੀ ਸਨ

ਜਿਨਾਂ ਦੇ ਰਾਹੀਂ ਲੋਕ ਕੀ ਆਪਣਾ ਜੋ ਕੀ ਛੋਟਾ ਕਾਰੋਬਾਰ ਹੈ ਛੋਟੇ ਵਪਾਰੀ ਆਪਣੇ ਕਾਰੋਬਾਰ ਨੂੰ ਦੇਸ਼ ਦੁਨੀਆ ਦੇ ਵੱਡੇ ਵੱਡੇ ਸ਼ਹਿਰਾਂ ਤੱਕ ਵੀ ਪਹੁੰਚਾ ਸਕਦੇ ਹਨ ਤਾਂ ਕਿ ਦੂਰ ਬੈਠੇ ਲੋਕ ਵੀ ਉਹਨਾਂ ਦਾ ਕਾਰੋਬਾਰ ਨੂੰ ਜਾਣ ਸਕਣ ਤੇ ਉਹਨਾਂ ਦਾ ਸੇਲ ਵਿੱਚ ਵਾਧਾ ਕਰ ਸਕਣ ਸੋਸ਼ਲ ਮੀਡੀਆ ਅਕਾਊਂਟ ਜਿਵੇਂ ਕੀ ਫੇਸਬੁਕ ਅਤੇ ਇੰਸਟਾਗ੍ਰਾਮ ਉੱਤੇ ਲੋਕ ਆਪਣੇ ਜੋ ਕੀ ਕਾਰੋਬਾਰ ਦੇ ਨਾਲ ਰਿਲੇਟਡ ਵੀਡੀਓਜ ਨੂੰ ਅਪਲੋਡ ਕਰਦੇ ਹਨ ਆਪਣੇ ਸਮਾਨ ਦੀ ਖਰੀਦ ਵੇਚ ਕਰ ਸਕਦੇ ਹਨ ਉਥੇ ਲੋਕਾਂ ਨੂੰ ਜੋ ਕੀ ਦੂਰ ਬੈਠੇ ਲੋਕ ਵੀ ਉਹਨਾਂ ਦੇ ਸਮਾਨ ਤੱਕ ਪਹੁੰਚ ਸਕਣ ਉਹਨਾਂ ਨੂੰ ਆਪਣੇ ਸਮਾਨ ਦੇ ਨਾਲ ਰਿਲੇਟਡ ਜਾਣਕਾਰੀ ਪ੍ਰਦਾਨ ਕਰਦੇ ਹਨ ਇਹ ਜਾਣਕਾਰੀ ਲੋਕਾਂ ਤੱਕ ਪਹੁੰਚਦੀ ਹੈ ਤੇ ਜਿੱਥੋਂ ਕੀ ਲੋਕਾਂ ਨੂੰ ਸਮਾਨ ਖਰੀਦਣ ਦੇ ਵਿੱਚ ਮਦਦ ਮਿਲਦੀ ਹੈ ਸਾਡੇ ਕੋਲ ਵੀ ਇੱਕ ਕਾਰੋਬਾਰ ਛੋਟਾ ਜਿਹਾ ਕਾਰੋਬਾਰ ਸੀ ਜਿਸ ਨਾਲ ਟੈਕਨੋਲੋਜੀ ਨੇ ਜਿਸ ਵਿੱਚ ਬਹੁਤ ਵਾਧਾ ਕੀਤਾ ਅਤੇ ਸਾਡੀ ਉਸ ਕਮਾਈ ਵਿੱਚ ਵੀ ਬਹੁਤ ਜਿਆਦਾਂ ਵਾਧਾ ਕੀਤਾ ਇਸ ਕਮਾਈ ਧੰਨਵਾਦ